ਬਿਨਾਂ ਗਲਤੀ ਤੋਂ ਸੁਧਾਰ ਲਈ ਸਲਾ ਥੋੜ੍ਹੇ ਖੇਤਰ ਵਿੱਚ ਮੁਖਤਿਆਰ ਜਾਂ ਪੁਲਿਸ ਦੇ ਸੁਰੱਖਿਅਤ ਨੌਕਰੀਆਂ ਅਤੇ ਵਿਕਾਸ ਅਤੇ ਘਰਾਂ ਦੀ ਮਿਆਰ ਨੂੰ ਵਧਾਉਣ ਲਈ ਤਿਆਰ ਕਰਨ ਲਈ ਦਿਲਚਸਪੀ ਰੱਖਦੇ ਹਨ ਇਸ ਨਾਲ ਇੰਟਰਨੈੱਟ ਸੰਚਾਰ ਟੈਕਨੋਲਜੀ ਦੇ ਵਿਕਾਸ ਨੂੰ ਸਹੂਲਤਾਂ ਦੇ ਨਿਰਮਾਣ ਦੇ ਨਰ ਵਿੱਚ ਉਨ੍ਹਾਂ ਦੀ ਹਿਮਾਇਤ ਵਧਾਉਣ ਲਈ ਮਦਦ ਕੀਤੀ ਜਾਂਦੀ ਹੈ ਸੁਰੱਖਿਅਤ ਪ੍ਰੋਟੋਕੋਲ ਤਕਨੀਕ ਸਹਿਯੋਗ ਇਹਨਾਂ ਥਾਵਾਂ ਮਹਿਲਾਵਾਂ ਅਨੁਰੂਪਾਂ ਸਮੂਹ ਵਧੇਰੇ ਸੁਰੱਖਿਅਤ ਇੱਛੁਕ ਬਣਾਉਣ ਵਿੱਚ ਮਦਦ ਕਰਦੇ ਹਨ ਇਹ ਸਮੁੱਚੇ ਸਮਾਜ ਉੱਤੇ ਕੀ ਅਤੇ ਨਵੇਂ ਨਵੇਂ ਦਾਅ ਸਹੂਲਤਾਂ ਉਪਲੱਬਧ ਬਣਾਉਂਦੇ ਹਨ ਰਿਵਾਇਤੀ ਕਿੱਤਿਆਂ ਵਿੱਚ ਚੁਣੌਤੀ ਮਿੱਟੀ ਦੇ ਬਰਤਨ ਜੋ ਰਿਵਾਇਤੀ ਕਿੱਤੇ ਹੁੰਦੇ ਹੈ ਇਸ ਦੇ ਨਾਲ ਜੋ ਸ਼ਹਿਰੀ ਖੇਤਰ ਹੁੰਦੇ ਆ ਉਨ੍ਹਾਂ ਨੂੰ ਜ਼ਿਆਦਾ ਸਹੂਲਤ ਮਿਲਦੀ ਹੈ